ਸਮੇਂ ਦੇ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਜਿਹੜੀ ਆ ਉਹ ਬਹੁਤ ਬਦਲਦੀ ਜਾ ਰਹੀ ਹੈ ਖਾਸ ਕਰਕੇ ਹੋਰ ਭਾਸ਼ਾਵਾਂ ਹੋਰ ਭਾਸ਼ਾਵਾਂ 'ਤੇ ਪੰਜਾਬੀ ਸੱਭਿਆਚਾਰਕ ਦੇ ਨਾਲ ਇਹਦੇ ਜਿਹੜੇ ਬਹੁਤ ਪ੍ਰਭਾਵ ਪੈ ਰਹੇ ਆ ਪੰਜਾਬੀ ਆ ਜਿਹੜੀ ਉਹ ਭਾਰਤ ਦੇ ਪੰਜਾਬ ਰਾਜ ਦੀ ਹੈ ਜਿਹੜੀ ਸਰਕਾਰੀ ਭਾਸ਼ਾ ਹੈਗੀ ਆ ਅਤੇ ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈਗੀ ਆ ਵੈਸੇ ਤਾਂ ਪੰਜਾਬ ਵਿੱਚ ਪੰਜਾ ਪੰਜਾਬੀ ਹੀ ਜ਼ਿਆਦਾਤਰ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ ਅਤੇ ਇਹ ਪੰਜਾਬ ਤੋਂ ਬਾਹਰ ਵੀ ਬੋਲੀ ਜਾਂਦੀ ਹੈ ਅਤੇ ਜਿਵੇਂ ਕਿ ਅੱਜ ਕੱਲ੍ਹ ਲੋਕਾਂ ਵਿੱਚ ਬਾਹਰ ਜਾਣ ਦਾ ਟਰੈਂਡ ਬਹੁਤ ਜ਼ਿਆਦਾ ਵੱਧ ਗਿਆ ਗਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਕਰਕੇ ਲੋਕ ਆਈਲੈਟਸ ਵੱਲ ਜਾਂ ਹੋਰ ਇੰਗਲਿਸ਼ ਲੈਂਗੁਏਜ ਵੱਲ ਜ਼ਿਆਦਾ ਧਿਆਨ ਦੇ ਦੇ ਰਹੇ ਆ ਜਿਹਨਾਂ ਕਾਰਨ ਪੰਜਾਬੀ ਦੀ ਜਿਹੜੀ ਕਦਰ ਆ ਬਹੁਤ ਘੱਟ ਰਹੀ ਹੈ ਜਿਵੇਂ ਕਿ ਟਾਈਮ ਆ ਜਿਹੜਾ ਟਾਈਮ ਪੀਸ ਹੋ ਗਿਆ ਜਾਂ ਟਾਈਮ ਹੋ ਗਿਆ ਇਹ ਇੰਗਲਿਸ਼ ਦਾ ਵਰਡ ਹੈਗਾ ਜਿਹਨੂੰ ਕਿ ਅਨਪੜ੍ਹ ਲੋਕ ਵੀ ਟਾਈਮ ਪੀਸ ਹੀ ਕਹਿ ਟਾਈਮ ਪੀਸ ਹੀ ਕਹਿ ਦਿੰਦੇ ਹੈ ਵੈਸੇ ਤਾਂ ਇਹਨੂੰ ਸਮਾਂ ਸਾਰ ਸਮਾਂ ਸਾਰਣੀ ਕਿਹਾ ਜਾਂਦਾ ਹੈ ਜਿਹਨਾਂ ਨਾਲ ਪੰਜਾਬੀ ਸਮੇਂ ਦੇ ਨਾਲ ਨਾਲ ਪੰਜਾਬੀ ਦੀ ਜਿਹੜੀ ਭਾਸ਼ਾ ਉਹ ਬਹੁਤ ਬਦਲਦੀ ਜਾ ਰਹੀ ਹੈ